ਡਾਂਸ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਇਕੱਠਾ ਲਿਆ ਸਕਦਾ ਹੈ ਉਹਦੇ ਨਾਲ ਤਾਂ ਭਾਈਚਾਰੇ ਦੀ ਭਾਵਨਾ ਵੀ ਬਹੁਤ ਵੱਧਦੀ ਹੈ ਡਾਂਸ ਦੇ ਵਿੱਚ ਜਿਹੜਾ ਹੁੰਦਾ ਹੈ ਕਿ ਭੰਗੜਾ ਜਦੋਂ ਪੈਂਦਾ ਹੈ ਤਾਂ ਲੋਕਾਂ ਦੇ ਪੈਰ ਤਾਂ ਆਪਣੇ ਆਪ ਹੀ ਥਿੜਕਣੇ ਸ਼ੁਰੂ ਹੋ ਜਾਂਦੇ ਹਨ ਉਹਦੇ ਵਿੱਚ ਇਹ ਹੁੰਦਾ ਜਿਹੜਾ ਨਹੀਂ ਵੀ ਨੱਚਦਾ ਉਹਦੇ ਦੇ ਉਹ ਅਸੀਂ ਉਹਨਾਂ ਨੂੰ ਜ਼ਬਰਦਸਤੀ ਖਿੱਚ ਖਿੱਚ ਕੇ ਲਿਆਉਂਦੇ ਹਾਂ ਅਤੇ ਨ ਨਚਾਉਂਦੇ ਹਾਂ ਪੰਜਾਬ ਦੇ ਪੰਜਾਬੀ ਲੋਕ ਤਾਂ ਡਾਂ ਨੱਚਣ ਦੇ ਤਾਂ ਬਹੁਤ ਹੀ ਜ਼ਿਆਦਾ ਸ਼ੌਕੀਨ ਹਨ ਕਿਤੇ ਵੀ ਭੰਗੜਾ ਪੈਂਦਾ ਹੋਵੇ ਢੋਲ ਵੱਜਦਾ ਹੋਵੇ ਉਹ ਤਾਂ ਆਪਣੇ ਆਪ ਹੀ ਨੱਚਣਾ ਸ਼ੁਰੂ ਕਰ ਦਿੰਦੇ ਹਨ ਇਹਦੇ ਨਾਲ ਇਹ ਹੁੰਦਾ ਹੈ ਕਿ ਲੋਕ ਇੱਕ ਦੂਜੇ ਨਾਲ ਜੁੜਦੇ ਹਨ ਅਤੇ ਭਾਈਚਾਰੇ ਦੀ ਭਾਵਨਾ ਵੱਧਦੀ ਹੈ ਇੱਕ ਦੂਸਰੇ ਨਾਲ ਅਤੇ ਉਹ ਇੱਕ ਦੂਸਰੇ ਦੇ ਮਿੱਤਰ ਬਣਦੇ ਹਨ ਜਿਹਦੇ ਨਾਲ ਦੁਸ਼ਮਣੀ ਖਤਮ ਹੁੰਦੀ ਹੈ ਕਈ ਵਾਰੀ ਇਹ ਵੀ ਹੁੰਦਾ ਕਿ ਦੁਸ਼ਮਣ ਵੀ ਆਪਸ ਦੇ ਵਿੱਚ ਕਿਤੇ ਫੰਕਸ਼ਨ 'ਤੇ ਵਿਆਹ ਵਿਆਹ ਸ਼ਾਦੀਆਂ 'ਤੇ ਗਏ ਹੋਣ ਅਤੇ ਉੱਥੇ ਵੀ ਕਿਤੇ ਢੋਲ ਢੂਲ ਵੱਜਦਾ ਹੋਵੇ ਤਾਂ ਉਹ ਆਪਸ ਵਿੱਚ ਨੱਚਣਾ ਸ਼ੁਰੂ ਕਰ ਦਿੰਦੇ ਹਨ ਜਿਹਦੇ ਨਾਲ ਇਹ ਹੁੰਦਾ ਕਿ ਉਹਨਾਂ ਦੀ ਦੁਸ਼ਮਣੀ ਦੂਰ ਹੋ ਜਾਂਦੀ ਹੈ ਉਹ ਆਪਸ ਵਿੱਚ ਗਲੇ ਵੀ ਮਿਲ ਪਾਉਂਦੇ ਹਨ ਅਤੇ ਇਹ ਹੈ ਕਿ ਡਾਂਸ ਲੋਕਾਂ ਨੂੰ ਦੂਰ ਕਰਨ ਦੀ ਬਜਾਏ ਕੋਲ ਲੈ ਕੇ ਆਉਂਦਾ ਅਤੇ ਉਹਦੇ ਨਾਲ ਇਹ ਹੁੰਦਾ ਕਿ ਉਹਨਾਂ ਦੀ ਆਪਸ ਦੇ ਵਿੱਚ ਛਤੁਰਤਾ ਖਤਮ ਹੋ ਕੇ ਮਿੱਤਰਤਾ ਵੱਧਦੀ ਹੈ ਅਤੇ ਉਹ ਪੰਜਾਬੀ ਦੇ ਬਹੁਤ ਜ਼ਿਆਦਾ ਨੱਚਣ ਦੇ ਸ਼ੌਕੀਨ ਹਨ ਐਨਾ ਜ਼ਿਆਦਾ ਨੱਚਦੇ ਹਨ ਕਿ ਪੂਰੀ ਪੂਰੀ ਰਾਤ ਹੀ ਭ ਭੰਗੜੇ 'ਤੇ ਡਾਂਸਾਂ 'ਤੇ ਡੀਜ਼ਿਆਂ 'ਤੇ ਨੱਚਦੇ ਰਹਿੰਦੇ ਹਨ